ਭਾਰਤ ਵਿੱਚ ਉੱਦਮੀ ਲਈ ਮੌਜੂਦ ਮੌਕੇ ਚੁਣੌਤੀਆਂ ਅਤੇ ਸ ਸਰਕਾਰੀ ਮਦਦ ਭਾਰਤ ਉੱਦਮੀਆਂ ਲਈ ਇੱਕ ਉਤਸ਼ਾਹਜਨਕ ਅਤੇ ਤੇਜ਼ੀ ਨਾਲ ਵਿਕਾਸ ਕਰ ਰਿਹਾ ਦੇਸ਼ ਹੈ ਨਵੀਂ ਉਦਯੋਗਿਕ ਵਿਕਾਸ ਜਿਵੇਂ ਐਮ ਐਸ ਐਮ ਈ ਮਾਈਕਰੋ ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜਿਸ ਸਟਾਰਟਅਪਸ ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੀਆਂ ਪਹਿਲ ਬੰਦੀਆਂ ਕਾਰੋਬਾਰ ਸ਼ੁਰੂ ਕਰਨ ਵਿੱਚ ਵਧੀਆ ਮੌਕੇ ਪੈਦਾ ਕਰ ਰਹੀਆਂ ਹਨ ਉੱਦਮਿਤਾ ਲਈ ਮੌਕੇ ਜਿਵੇਂ ਡਿਜੀਟਲ ਈਕਮਰਸ ਬੂ ਜਿਵੇਂ ਈਕਮਰਸ ਵਿੱਚ ਆ ਜਾਂਦਾ ਹੈ ਜਿਵੇਂ ਐਮਾਜੋਨ ਫਲਿਪਕਾਰਡ ਮੀਸ਼ੋ ਅਤੇ ਡਾਇਰੈਕਟ ਟੂ ਕੰਜ਼ਿਊਮਰ ਬ੍ਰਾਂਡ ਵੱਧ ਰਹੇ ਹਨ ਯੂ ਪੀ ਆਈ ਫਰੰਟਾਈਕ ਆਨਲਾਈਨ ਪੇਮੈਂਟਸ ਨਾਲ ਫੋਨਪੇ ਪੇਟੀਐਮ ਜ਼ੀਰੋਦਾ ਨੂੰ ਉਤਸ਼ਾਹ ਮਿਲ ਰਿਹਾ ਹੈ ਐਮ ਐਸ ਐਮ ਈ ਅਤੇ ਨਿੱਜੀ ਉਦਯੋਗ ਐਮ ਐਸ ਐਮ ਈ ਖੇਤਰ ਨੂੰ ਬਹੁਤ ਮੌਕੇ ਹਨ ਜਿਵੇਂ ਕਿ ਮੈਨੂਫੈਕਚਰਿੰਗ ਗਰੀਨ ਐਨਰਜੀ ਇਲੈਕਟ੍ਰਿਕ ਵਾਹੀਕਲਮ ਟੈਕਸਟਾਈਲ ਫੂਡ ਪ੍ਰੋਸੈਸਿੰਗ ਟੂਰਿਜਮ ਸਰਕਾਰ ਵੱਲੋਂ ਉੱਦਮੀਆਂ ਲਈ ਮੁੱਖ ਮਦਦ ਇਹ ਹੈ ਕਿ ਸਟਾਰਟਅਪ ਇੰਡੀਆ ਮਿਸ਼ਨ ਨਵੇਂ ਸਟਾਰਟਅਪ ਲਈ ਤਿੰਨ ਸਾਲ ਤੱਕ ਟੈਕਸ ਹੋਲੀਡੇ ਅਤੇ ਸੈਲਫ ਸਰਟੀਫਿਕੇਸ਼ਨ ਦੀ ਸੁਵਿਧਾ ਹੈ ਗਵਰਨਮੈਂਟ ਈ ਮਾਰਕੀਟ ਪੈਲ ਪਲੇਸ ਰਾਹੀਂ ਸਟਾਰਟਅਪ ਸਰਕਾਰੀ ਟੈਂਡਰ ਜਿੱਤ ਸਕਦੇ ਮੁਦਰਾ ਲੋਨ ਯੋਜਨਾ ਛੋਟੇ ਕਾਰੋਬਾਰਾਂ ਲਈ ਪੰਜਾਹ ਹਜ਼ਾਰ ਤੋਂ ਦਸ ਲੱਖ ਤੱਕ ਲੋਨ ਜਿਵੇਂ ਕਰਿਆਨਾ ਸਟੋਰਸ 'ਤੇ ਵਰਤ ਸਕਦੇ ਹਨ